ਪੰਜਾਬੀਆਂ ਦੇ ਪਿੰਡਾਂ ਵਿੱਚ ਬਹੁਤ ਹੀ ਵਿਲੱਖਣ ਬਹੁਤ ਹੀ ਲੋਕ ਨਾਚ ਹੈ ਪ੍ਰਸਿੱਧ ਹਨ ਜਿਵੇਂ ਭੰਗੜਾ ਮਲਵਈ ਗਿੱਧਾ ਝੂੰਮਰ ਗਿੱਧਾ ਕੁੜੀਆਂ ਦਾ ਫੇਮਸ ਪੰਜਾਬੀ ਹਰ ਇੱਕ ਤਿਉਹਾਰ ਖੁਸ਼ੀ ਦੇ ਮੌਕੇ ਜਿਵੇਂ ਕਿ ਵਿਆਹ ਹੋ ਗਿਆ ਵਿਆਹ 'ਤੇ ਭੰਗੜੇ ਪਾਏ ਜਾਂਦੇ ਹਨ ਤਿਉਹਾਰ ਜਿਵੇਂ ਦਿਵਾਲੀ ਦੁਸਹਿਰਾ ਅਤੇ ਰੱਖੜੀ ਲੋਹੜੀ ਇਹਨਾਂ 'ਤੇ ਵੱਖ ਵੱਖ ਤਿਉਹਾਰਾਂ ਦੇ ਉੱਪਰ ਪੰਜਾਬੀ ਆਪਣੀ ਖੁਸ਼ੀ ਨੂੰ ਪ੍ਰਗਟ ਕਰਨ ਲਈ ਭੰਗੜੇ ਪਾਉਂਦੇ ਨੇ ਨੱਚਦੇ ਨੇ ਢੋਲ ਉੱਪਰ ਗਾਣਿਆਂ ਉੱਪਰ ਪੰਜਾਬੀਆਂ ਦੇ ਜੋ ਗਾਣੇ ਨੇ ਉਹ ਵੀ ਇੰਨੇ ਕੁ ਜ਼ਿਆਦਾ ਖੁਸ਼ੀ ਭਰੇ ਨੇ ਕਿ ਪੰਜਾਬੀ ਗਾਣਾ ਸੁਣਦਿਆਂ ਸਾਰ ਹੀ ਨੱਚਣ ਲੱਗ ਜਾਂਦੇ ਨੇ ਪੰਜਾਬੀ ਪ੍ਰਸਿੱਧ ਹੀ ਲੋਕ ਨਾਚਾਂ ਕਰਕੇ ਨੇ ਉਹਨਾਂ ਦੇ ਦਿਲ ਜਿੰਨੇ ਵੱਡੇ ਨੇ ਉੱਨੇ ਹੀ ਉਹਨਾਂ ਦੇ ਲੋਕ ਨਾਚ ਪ੍ਰਸਿੱਧ ਨੇ ਪੰਜਾਬੀਆਂ ਦੇ ਹਰ ਇੱਕ ਖੁਸ਼ੀ ਦੇ ਮੌਕੇ 'ਤੇ ਸਾਜ ਵਜਾਏ ਜਾਂਦੇ ਨੇ ਭੰਗੜੇ ਪਾਏ ਜਾਂਦੇ ਨੇ ਨੱਚ ਕੇ ਖੁਸ਼ੀ ਨੂੰ ਪ੍ਰਗਟ ਕੀਤਾ ਜਾਂਦਾ ਹੈ